ਮੈਨੂੰ ਇੱਕ ਅਜਿਹੀ ਸਾਂਝ ਪਸੰਦ ਹੈ ਜੋ ਕਿ ਮੇਰੇ ਸਰੀਰ ਅਤੇ ਦਿਮਾਗ ਦੋਨਾਂ ਲਈ ਬਹੁਤ ਲਾਭਦਾਇਕ ਹੈ ਜਿਸ ਦਾ ਨਾਮ ਹੈ ਗੀਟਾਰ ਗੀਟਾਰ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਕਿਉਂਕਿ ਉਹ ਮੇਰੇ ਸਰੀਰ ਅਤੇ ਦਿਮਾਗ ਦੋਨਾਂ ਲਈ ਬਹੁਤ ਲਾਭਦਾਇਕ ਹੈ ਉਹ ਮੈਨੂੰ ਬਹੁਤ ਆਰਾਮ ਦਿੰਦੀ ਹੈ ਅਤੇ

ਹਰ ਇੱਕ ਪਰਿਸਥਿਤੀ ਵਿੱਚ ਮੇਰੇ ਦਿਮਾਗ ਨੂੰ ਸ਼ਾਂਤ ਰੱਖਦੀ ਹੈ ਮੈਨੂੰ ਗਾਣਾ ਗਾਉਣ ਦੇ ਨਾਲ ਨਾਲ ਗਿਟਾਰ ਵਜਾਉਣਾ ਬਹੁਤ ਪਸੰਦ ਹੈ ਅਤੇ ਮੈਂ ਗਿਟਾਰ ਦੀਆਂ ਬਹੁਤ ਸਾਰੀਆਂ ਪ੍ਰੀਕਸ਼ਾਵਾਂ ਵੀ ਦਿੱਤੀਆਂ ਹੋਈਆਂ ਹਨ ਜਿਸ ਨਾਲ ਕਿ ਮੈਨੂੰ ਗਿਟਾਰ ਵਜਾਉਣ ਵਿੱਚ

ਰੋਕ ਜਾਂ ਅੜਚਨ ਨਹੀਂ ਆਉਂਦੀ ਮੈਂ ਬਹੁਤ ਵਧੀਆ ਗਿਟਾਰ ਵਜਾ ਸਕਦਾ ਹਾਂ

ਕਈ ਵਾਰੀ ਮੈਂ ਗਿਟਾਰ ਇਸ ਲਈ ਵਜਾਉਂਦਾ ਹਾਂ ਕਿਉਂਕਿ

ਘਰ ਵਿੱਚ ਵੀ ਮੇਰੇ ਮਾਤਾ ਪਿਤਾ ਨੂੰ ਉਹ ਬਹੁਤ ਪਸੰਦ ਹੈ ਮੈਂ ਗਿਟਾਰ ਆਪਣੀ ਦਸਵੀਂ ਸ਼੍ਰੇਣੀ ਤੋਂ ਸਿੱਖਦਾ ਆ ਰਿਹਾ ਹਾਂ ਗਿਟਾਰ ਇੱਕ ਅਜਿਹੀ ਚੀਜ਼ ਹੈ ਜੋ ਕਿ ਦਿਮਾਗ ਨੂੰ ਬਹੁਤ ਲਾਭ ਦਿੰਦੀ ਹੈ ਅਤੇ ਹਰ ਪਰਿਸਥਿਤੀ ਵਿੱਚ ਆਦਮੀ ਨੂੰ ਸ਼ਾਂਤ ਰਹਿਣਾ ਸਿਖਾਉਂਦੀ ਹੈ